ਪੰਜਾਬ ਵਿੱਚ ਜੀਵਨ ਦੇ ਢੰਗਾਂ ਨੂੰ ਅਕਾਰ ਦੇਣ ਵਾਲੇ ਪ੍ਰਮੁੱਖ ਸੱਭਿਆਚਾਰਕ ਪ੍ਰਭਾਵ ਇਹ ਹਨ ਕਿ ਇਤਿਹਾਸ ਵਿੱਚ ਜਦੋਂ ਅਨੰਦਪੁਰ ਸਾਹਿਬ ਵਿੱਚ ਸਿੱਖਾਂ ਨੂੰ ਘੇਰਾ ਵ ਸਿੱਖਾਂ ਨੂੰ ਘੇਰਾ ਪਾਇਆ ਸੀ ਤਾਂ ਕਈ ਸਿੱਖ ਗੁਰੂ ਦੇ ਗੁਰੂ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਚਲੇ ਗਏ ਸਨ ਤਾਂ ਔਰਤਾਂ ਨੇ ਕਿਹਾ ਸੀ ਕਿ ਤੁਸੀਂ ਆਪਣੇ ਗੁਰੂ ਨੂੰ ਛੱਡ ਕੇ ਕਿਉਂ ਜਾ ਰਹੇ ਹੋ ਤੁਹਾਨੂੰ ਚੂੜੀਆਂ ਪਾਉਣੀਆਂ ਚਾਹੀਦੀਆਂ ਹਨ ਤੁਸੀਂ ਤਾਂ ਔਰਤਾਂ ਤੋਂ ਵੀ ਗਏ ਗੁਜ਼ਰੇ ਹੋ ਇਸ ਇਸ ਦੀ ਸਭ ਤੋਂ ਵੱਡੀ ਸਭ ਤੋਂ ਵੱਡੀ ਐਗਜੈਂਪਲ ਐਗਜੈਂਪਲ ਮਾਈ ਭਾਗੋ ਹੈ ਜਿਸ ਨੇ ਜਿਸ ਨੇ ਸ਼ਸਤਰਬਾਜ਼ੀ ਸਿੱਖੀ ਅਤੇ ਯੁੱਧ ਵਿੱਚ ਭਾਗ ਲਿਆ ਦੱਸਿਆ ਕਿ ਸਿੱਖ ਕੁੜੀਆਂ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਉਹਨਾਂ ਨੂੰ ਆਪਣੀ ਰੱਖਿਆ ਲਈ ਸ਼ਸਤਰਬਾਜ਼ੀ ਸਿੱਖਣੀ ਚਾਹੀਦੀ ਹੈ ਤਾਂ ਕਿ ਮਾੜੇ ਸਮੇਂ ਵਿੱਚ ਤਾਂ ਕਿ ਮਾੜੇ ਸਮੇਂ ਵਿੱਚ ਉਹ ਆਪਣੇ ਜੀਵਨ ਜੀਵਨ ਡ ਜੀਵਨ ਵਿੱਚ ਰੱਖਿਆ ਕਰ ਸਕਣ